ਅਸੀਂ ਮਾਨਸੂਨ ਮੌਸਮ ਦੇ ਵਿੱਚ ਘੁੰਮਣਾ ਪਸੰਦ ਕਰਦੇ ਹੈਗੇ ਉਦੋਂ ਅਸੀਂ ਜਦੋਂ ਮਾਨਸੂਨ ਮੌਸਮ ਹੋ ਜਾਂਦਾ ਹੈ ਤਾਂ ਉਦੋਂ ਅਸੀਂ ਆਪਣੀ ਫੈਮਲੀ ਦੇ ਨਾਲ ਉਹ ਬਾਹਰ ਕਿਤੇ ਘੁੰਮਣ ਦੇ ਲਈ ਜਾਂਦੇ ਹਾਂ ਕਿਉਂਕਿ ਸਾਡਾ ਇਲਾਕਾ ਗਰਮ ਹੋ ਠੀਕ ਤਰੀਕੇ ਨਾਲ ਹੁੰਦਾ ਹੈ ਅਤੇ ਦੂਜੇ ਇਲਾਕੇ ਵੱਲ ਵਧੀਆ ਠੰਢਾ ਇਲਾਕਾ ਹੁੰਦਾ ਹੈ ਜਿਸ ਜਿਹਦੇ ਵਿੱਚ ਘੁੰਮਣਾ ਬਹੁਤ ਆਨੰਦ ਆਉਂਦਾ ਹੈ ਤਾਂ ਇਸ ਤਰ੍ਹਾਂ ਅਸੀਂ ਘੁੰਮਣਾ ਘੁੰ ਘੁੰਮਣ ਜਾਂਦੇ ਹਾਂ ਤਾਂ ਅਸੀਂ ਉੱਥੇ ਬਹੁਤ ਸਾਰਾ ਇੰਜੋਏ ਕਰਦੇ ਹਾਂ ਉਸ ਮੌਸਮ ਦੇ ਵਿੱਚ ਅਤੇ ਉਹ ਮੌਸਮ ਬਹੁਤ ਹੀ ਵਧੀਆ ਮੌਸਮ ਹੁੰਦਾ ਹੈ ਨਾ ਤਾਂ ਜ਼ਿਆਦਾ ਗਰਮੀ ਹੁੰਦੀ ਹੈ ਨਾ ਹੀ ਜ਼ਿਆਦਾ ਸਰਦੀ ਹੁੰਦੀ ਹੈ ਜਿਸ ਨਾਲ ਅਸੀਂ ਘੁੰਮ ਕੇ ਸਾਨੂੰ ਵਧੀਆ ਲੱਗਦਾ ਹੈ ਅਸੀਂ ਉਸ ਉਸ ਮੌਸਮ ਦੇ ਵਿੱਚ ਘੁੰਮਣ ਚਲੇ ਜਾਂਦੇ ਹਾਂ ਅਤੇ ਸਾਨੂੰ ਉਸ ਮੌਸਮ ਦੇ ਵਿੱਚ ਘੁੰਮਣਾ ਬਹੁਤ ਹੀ ਵਧੀਆ ਲੱਗਦਾ ਹੈ ਜਿਸ ਨਾਲ ਕਿ ਅਸੀਂ ਆਪਣੇ ਪਰਿਵਾਰਾਂ ਦੋਸਤਾਂ ਨਾਲ ਚਲੇ ਜਾਂਦੇ ਹਾਂ